ਸਤਿ ਸ਼੍ਰੀ ਅਕਾਲ ਜੀ ਮੈਂ ਰਮਨ ਗੱਲ ਕਰਦੀ ਹਾਂ ਮੈਂ ਥੋੜ੍ਹਾ ਸਮਾਂ ਪਹਿਲਾਂ ਤੁਹਾਡੇ ਕੋਲ ਭੋ ਆਪਣੇ ਭੋਜਨ ਦਾ ਔਡਰ ਕੀਤਾ ਸੀ ਅਤੇ ਉਹ ਮੇਰੇ ਕੋਲ ਹਜੇ ਤੱਕ ਨਹੀਂ ਆਇਆ ਅਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਸੀਗਾ ਕਿ ਮੇਰਾ ਜਿਹੜਾ ਭੋਜਨ ਮੈਂ ਔਡਰ ਕੀਤਾ ਆ ਉਹ ਕਿੰਨੇ ਸਮੇਂ ਤੱਕ ਆਵੇਗਾ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿੰਨਾਂ ਟਾਈਮ ਲੱਗ ਜਾਵੇਗਾ ਮੇਰੇ ਕੋਲ ਪਹੁੰਚਣ ਲਈ ਅਤੇ ਮੈਨੂੰ ਉਹ ਥੋੜ੍ਹਾ ਜਿਹਾ ਜਲਦੀ ਚਾਹੀਦਾ ਆ ਸਾਡੇ ਘਰ ਗੈਸਟ ਆਏ ਹੋਏ ਨੇ ਅਤੇ ਬਾਕੀ ਤੁਹਾਨੂੰ ਪਤਾ ਆ ਨਾ ਕਿ ਕਿਹੜੇ ਪਤੇ 'ਤੇ ਤੁਸੀਂ ਖਾਣਾ ਭੇਜਣਾ ਹੈ ਤਾਂ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਰੀਪੀਟ ਕਰ ਦਿੰਦੀ ਹਾਂ ਤੁਸੀਂ ਗਲੀ ਨੰਬਰ ਪੰਜ ਦੇ ਵਿੱਚ ਤਿੰਨ ਸੌ ਛੇ ਨੰਬਰ ਘਰ ਦੇ ਵਿੱਚ ਸਾਡਾ ਜਿਹੜਾ ਭੋਜਨ ਆ ਉਹ ਫੜਾ ਕੇ ਜਾਣਾ ਹੈ ਅਤੇ ਤੁਸੀਂ ਮੈਨੂੰ ਆਪਣੀ ਲੌਕੇਸ਼ਨ ਦਾ ਦੱਸ ਸਕਦੇ ਹੋ ਤੁਸੀਂ ਇਸ ਟਾਈਮ ਕਿੱਥੇ ਹੋ ਤਾਂ ਤੁਸੀਂ ਆਪਣੇ ਰੈਸਟੋਰੈਂਟ ਤੋਂ ਨਿਕਲ ਗਏ ਹੋ ਜਾਂ ਨਹੀਂ ਤਾਂ ਤੁਸੀਂ ਮੈਨੂੰ ਨਾ ਆਪਣੀ ਲੌਕੇਸ਼ਨ ਔਨ ਕਰਕੇ ਭੇਜ ਸਕਦੇ ਹੋ ਐਪ 'ਤੇ ਤਾਂ ਕਿ ਮੈਂ ਦੇਖਦੀ ਰਹਾਂ ਕਿ ਤੁਸੀਂ ਕਿੱਥੇ ਪਹੁੰਚੇ ਹੋ ਅਤੇ ਬਾਕੀ ਤੁਸੀਂ ਮੈਨੂੰ ਮੇਰਾ ਸਮੇਂ ਸਿਰ ਭੋਜਨ ਜ਼ਰੂਰ ਡਿਲੀਵਰ ਕਰਨਾ